ਚੰਗੇ ਕਿਰਦਾਰਾਂ ਵਾਲਾ ਵਿਅਕਤੀ ਸਮਾਜ ਵਿੱਚ ਬਹੁਤ ਤਰੱਕੀ ਕਰਦਾ ਹੈਗਾ ਅਤੇ ਸਮਾਜ ਨੂੰ ਅੱਗੇ ਵਧਾਉਂਦਾ ਗਾ ਜੇ ਵਿਅਕਤੀ ਦਾ ਕਿਰਦਾਰ ਚੰਗਾ ਹੁੰਦਾ ਗਾ ਤਾਂ ਉਸ 'ਤੇ ਹਰ ਵਿਅਕਤੀ ਅੱਖ ਬੰਦ ਕਰਕੇ ਭਰੋਸਾ ਕਰ ਸਕਦਾ ਹੈਗਾ ਪਰ ਜੇਕਰ ਵਿਅਕਤੀ ਦਾ ਕਿਰਦਾਰ ਚੰਗਾ ਨਾ ਹੋਵੇ ਤਾਂ ਉਸ 'ਤੇ ਕੋਈ ਵੀ ਵਿਸ਼ਵਾਸ ਨਹੀਂ ਕਰਨਾ ਚਾਹੁੰਦਾ ਜਿਵੇਂ ਜੇ ਅਧਿਆਪਕ ਕਹੇ ਤੁਸੀਂ ਝੂਠ ਨਹੀਂ ਬੋਲਣਾ ਪਰ ਉਹ ਆਪ ਖੁਦ ਝੂਠ ਬੋਲੇ ਤਾਂ ਉਸਦਾ ਕਿਰਦਾਰ ਚੰਗਾ ਨਹੀਂ ਸਮਝਿਆ ਜਾਂਦਾ ਪਰ ਜੇਕਰ ਅਧਿਆਪਕ ਆਪ ਵੀ ਝੂਠ ਨਾ ਬੋਲੇ ਅਤੇ ਬੱਚਿਆਂ ਨੂੰ ਵੀ ਸਿਖਾਵੇ ਉਹ ਝੂਠ ਨਾ ਬੋਲਣ ਤਾਂ ਉਸਦਾ ਕਿਰਦਾਰ ਚੰਗਾ ਹੋਵੇਗਾ ਇਸੇ ਤਰ੍ਹਾਂ ਨੇਤਾ ਪ੍ਰਧਾਨ ਦਾ ਕਿਰਦਾਰ ਚੰਗਾ ਹੋਣ ਕਰਕੇ ਹੀ ਉਹਨਾਂ ਨੂੰ ਵੱਧ ਵੋਟਾਂ ਮਿਲਣਗੀਆਂ ਅਤੇ ਉਹ ਜਿੱਤਣਗੇ ਪਰ ਜੇਕਰ ਨੇਤਾ ਪ੍ਰਧਾਨ ਦਾ ਕਿਰਦਾਰ ਮਾੜਾ ਹੋਵੇਗਾ ਤਾਂ ਕੋਈ ਵੀ ਵਿਅਕਤੀ ਉਸਨੂੰ ਵੋਟ ਪਾਉਣੀ ਪਸੰਦ ਨਹੀਂ ਕਰੇਗਾ ਇਸੇ ਤਰ੍ਹਾਂ ਜੇ ਡਾਕਟਰ ਦਾ ਕਿਰਦਾਰ ਚੰਗਾ ਹੋਵੇਗਾ ਤਾਂ ਉਸ ਕੋਲ ਵੱਧ ਤੋਂ ਵੱਧ ਮਰੀਜ਼ ਆਉਣਗੇ ਪਰ ਜੇ ਡਾਕਟਰ ਦਾ ਕਿਰਦਾਰ ਮਾੜਾ ਹੋਵੇਗਾ ਤਾਂ ਉਸ ਕੋਲ ਕੋਈ ਮਰੀਜ਼ ਆਉਣਾ ਪਸੰਦ ਨਹੀਂ ਕਰੇਗਾ ਇਸੇ ਤਰ੍ਹਾਂ ਕਿਰਦਾਰ ਹੀ ਸੰਸਾਰ ਦੀ ਅਸਲੀ ਪੂੰਜੀ ਹਨ ਜੇ ਕਿਰਦਾਰ ਚੰਗੇ ਹਨ ਤਾਂ ਆਪਾਂ ਆਪਦੇ ਜੀਵਨ ਵਿੱਚ ਹਰ ਚੀਜ਼ ਅਚੀਵ ਕਰ ਸਕਦੇ ਹਾਂ ਹਰ ਮਕਸਦ ਪ੍ਰਾਪਤ ਕਰ ਸਕਦੇ ਹਾਂ ਹਰ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ